ਹਾਂ ਮੈਂ ਵੱਖ ਵੱਖ ਕਿਸਮ ਦੇ ਪੰਛੀਆਂ ਨੂੰ ਖਾਣਾ ਖਾਂਦੇ ਤੇ ਫੀਡ ਕਰਦੇ ਵੇਖਿਆ ਹੈ ਜਿਵੇਂ ਕਬੂਤਰ ਮੱਖੀ ਬੱਤਖਾਂ ਤੇ ਤਿਤਲੀਆਂ ਤੇ ਦੂਜੇ ਪਕਸ਼ੀ ਇਹ ਅਨੁਭਵ ਕਾਫੀ ਦਿਲਚਸਪ ਤੇ ਖੂਬਸੂਰਤ ਹੁੰਦਾ ਹੈ ਜਦੋਂ ਵੀ ਮੈਂ ਪੰਛੀਆਂ ਨੂੰ ਫੀਡ ਕਰਦੇ ਕਰਦਾ ਹਾਂ ਮੈਂ ਵੱਖ ਵੱਖ ਖਾਨੇ ਦੀਆਂ ਚੀਜ਼ਾਂ ਦੀ ਵਰਤੋਂ ਕਰਦਾ ਹਾਂ ਜਿਵੇਂ ਕਬੂਤਰ ਉਹ ਅਕਸਰ ਅਨਾਜ ਤੇ ਚਾਵਲ ਖਾਂਦੇ ਹਨ ਮੱਖੀਆਂ ਇਹ ਅਕਸਰ ਰੋਟੀ ਦੇ ਟੁਕੜੇ ਜਾ ਥਾਣੇ ਦੇ ਬੱਚੇ ਟੁਕੜੇ ਖਾਂਦੀਆਂ ਹਨ ਬੱਤਖਾਂ ਬੱਤਖਾਂ ਰੋਜਾਨਾਂ ਪਾਣੀ ਵਿੱਚ ਤੈਰ ਕੇ ਫਲਾਂ ਤੇ ਖਾਸ ਤੌਰ ਤੇ ਹਰਿਆ ਭੋਜਨ ਖਾਣਾ ਪਸੰਦ ਕਰਦੀਆਂ ਹਨ ਜਿਵੇਂ ਕਿ ਮੱਕਈ ਦੇ ਦਾਣੇ ਜਾਂ ਸਲੇਬੀਆਂ ਤਿਤਲੀਆਂ ਤਿਤਲੀਆਂ ਅਤੇ ਹੋਰ ਕੁਦਰਤੀ ਪਕਸ਼ੀ ਇਹ ਬਹੁਤ ਪਸੰਦ ਕਰਦੇ ਹਨ ਖਾਸ ਤੌਰ ਤੇ ਛੋਟੇ ਦਾਣੇ ਜਿਵੇਂ ਕਿ ਸੂਰਜ ਮੁਖੀ ਦੇ ਬੀਜ ਜਾਂ ਚਨਾ ਫੀਡ ਕਰਨ ਦਾ ਅਨੁਭਵ ਪਕਸ਼ੀਆਂ ਨੂੰ ਖਿਲਾਣਾ ਇੱਕ ਬਹੁਤ ਹੀ ਪਿਆਰਾ ਅਨੁਭਵ ਹੁੰਦਾ ਹੈ ਜਦੋਂ ਵੀ ਮੈਂ ਉਹਨਾਂ ਨੂੰ ਖਾਣਾ ਦਿੰਦੀ ਹਾਂ ਉਹ ਬੜੀ ਸੋਹਣੇ ਤਰ੍ਹਾਂ ਥੋੜਾ ਥੋੜਾ ਕਰਕੇ ਖਾਣਾ ਖਾਂਦੇ ਹਨ ਕਈ ਵਾਰੀ ਮੈਂ ਵੇਖਦੀ ਹਾਂ ਉਹ ਆਪਣੇ ਬੱਚਿਆਂ ਨੂੰ ਵੀ ਖਾਣਾ ਦੇ ਰਹੇ ਹੁੰਦੇ ਹਨ ਜੋ ਮੈਨੂੰ ਬੜਾ ਵਧੀਆ ਲੱਗਦਾ ਹੈ ਇਹ ਪਕਸ਼ਿਆਂ ਤੇ ਨਰਮ ਅਤੇ ਭਰੋਸੇ ਯੋਗ ਹੁੰਦੇ ਹਨ ਜਦੋਂ ਤੁਸੀਂ ਉਹਨਾਂ ਦੇ ਨਾਲ ਕੁਝ ਸਮਾਂ ਬਿਤਾਉਂਦੇ ਹੋ ਉਹ ਤੁਹਾਡੇ ਕੋਲ ਆ ਕੇ ਖਾਣਾ ਖਾ ਲੈਂਦੇ ਹਨ ਇਹ ਅਨੁਭਵ ਨੇ ਮੈਨੂੰ ਪ੍ਰਕਿਰਿਆ ਤੇ ਜੀਵ ਜੰਤੂਆਂ ਨਾਲ ਜੋੜਨ ਦਾ ਇੱਕ ਨਵਾਂ ਅਹਿਸਾਸ ਦਿਲਵਾਇਆ ਇਹ ਬਹੁਤ ਹੀ ਆਤਮਿਕ ਸ਼ਾਂਤੀ ਦਾ ਹਿੱਸਾ ਬਣ ਜਾਂਦਾ ਹੈ ਅਤੇ ਮੈਂ ਦਿਲ ਤੋਂ ਖੁਸ਼ ਹੋ ਜਾਂਦੀ ਹਾਂ